ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਹੀ ਕਾਰੋਬਾਰ ਦੇ ਸਾਧਨ ਆ ਜਿਵੇਂ ਕਿ ਚੀਮਾ ਫੈਕਟਰੀ ਸਵਰਾਜ ਫੈਕਟਰੀ ਵੱਖ ਵੱਖ ਪ੍ਰਾਈਵੇਟ ਸਕੂਲਸ ਇੰਟਰਨੈਸ਼ਨਲ ਸਕੂਲਸ ਅਤੇ ਇੰਸਟੀਚਿਊਟਸ ਹਨ ਬਹੁਤ ਹੀ ਵੱਡੇ ਵੱਡੇ ਜਿੱਥੇ ਬੱਚੇ ਪੜ੍ਹਨ ਜਾਂਦੇ ਹਨ ਅਤੇ ਖੇਤੀਬਾੜੀ ਦਾ ਵੀ ਬਹੁਤ ਵੱਡਾ ਇੱਥੇ ਸਾਧਨ ਆ ਅਤੇ ਲੋਕਾਂ ਦੀਆਂ ਖੁਦ ਦੀਆਂ ਕਰਿਆਨੇ ਦੀਆਂ ਦੁਕਾਨਾਂ ਕੱਪੜੇ ਦੀਆਂ ਦੁਕਾਨਾਂ ਦਵਾਈ ਦੀਆਂ ਦੁਕਾਨਾਂ ਬਹੁਤ ਹੀ ਹਨ ਜਿੱਥੋਂ ਜਿਹੜੇ ਲੋਕਾਂ ਦੇ ਕਮਾਈ ਦੇ ਸ੍ਰੋਤ ਹਨ ਅਤੇ ਮੋਹਾਲੀ ਜ਼ਿਲ੍ਹਾ ਆਪ ਆਪਣੇ ਆਪ 'ਚ ਹੀ ਇੱਕ ਬਹੁਤ ਵੱਡਾ ਕਾਰੋਬਾਰ ਦਾ ਸਾਧਨ ਆ ਜਿੱਥੇ ਕਿ ਲੋਕਾਂ ਨੂੰ ਇੱਥੋਂ ਬਾਹਰ ਨਹੀਂ ਜਾਣਾ ਪੈਂਦਾ ਕਮਾਉਣ ਲਈ ਅਤੇ ਉਹ ਇੱਥੇ ਰਹਿ ਕੇ ਹੀ ਆਪਣੇ ਡੇਲੀ ਨੀਡਸ ਪੂਰੀਆਂ ਕਰ ਸਕਦੇ ਹਨ ਬਟ ਸਰਕਾਰ ਨੂੰ ਥੋੜ੍ਹੀ ਜਿਹੀ ਉਹਦੇ ਰਿਗਾਡਿੰਗ ਲਿਮਿਟਸ ਵਧਾ ਦੇਣੀਆ ਚਾਹੀਦੀਆਂ ਹਨ ਕਿਉਂਕਿ ਅੱਜ ਕੱਲ੍ਹ ਜਿੰਨੀ ਵੀ ਸੈਲਰੀਜ਼ ਮਿਲ ਰਹੀਆਂ ਸੱਤ ਅੱਠ ਹਜ਼ਾਰ ਕਿਸੇ ਦਾ ਵੀ ਉਹ 'ਚ ਗੁਜ਼ਾਰਾ ਨਹੀਂ ਪੂਰਾ ਹੁੰਦਾ ਕਿਉਂਕਿ ਅੱਜ ਕੱਲ੍ਹ ਲੋਕਾਂ ਦੀਆਂ ਲੋੜਾਂ ਬਹੁਤ ਵੱਧ ਗਈਆਂ ਹਨ ਅਤੇ ਬੱਚੇ ਹਰ ਇੱਕ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਹਨ ਤਾਂ ਕਿ ਉਹਨਾਂ ਦੇ ਬੱਚੇ ਅੱਗੇ ਜਾ ਕੇ ਵਧੀਆ ਨੌਕਰੀਆਂ ਕਰ ਸਕਣ ਵਧੀਆ ਲਾਈਫ ਜੀਅ ਸਕਣ